ਜੇਕਰ ਤੁਹਾਡੇ ਸਾਥੀ ਨੇ ਹਾਲ ਵਿੱਚ ਹੀ ਇੱਕ ਬੱਚੇ ਨੂੰ ਜਨਮ ਦਿੱਤਾ ਹੈ ਅਤੇ ਇਹ ਯਕੀਨ ਨਹੀਂ ਹੈ ਕਿ ਜਨਮ ਅਧਿਕਾਰ ਤੌਰ 'ਤੇ ਰਜਿਸਟਰ ਕੀਤਾ ਗਿਆ ਹੈ ਜਾਂ ਨਹੀਂ ਤਾਂ ਇਹ ਯਕੀਨੀ ਬਣਾਉਣ ਲਈ ਕਿ ਸਾਰੀਆਂ ਕਾਨੂੰਨੀ ਅਤੇ ਪ੍ਰਸ਼ਾਸਨਿਕ ਪ੍ਰਕਰਿਆਵਾਂ ਦੀ ਪਾਲਣਾ ਕੀਤੀ ਜਾਂਦੀ ਹੈ ਇਸ ਨੂੰ ਤੁਰੰਤ ਹੱਲ ਕਰਨਾ ਮਹੱਤਵਪੂਰਨ ਹੈ ਹਸਪਤਾਲ ਜਾਂ ਜਨਮ ਕੇਂਦਰ ਤੋਂ ਜਾਂਚ ਕਰਕੇ ਸ਼ੁਰੂ ਕਰੋ ਜਿੱਥੇ ਡਿਲੀਵਰੀ ਹੋਈ ਸੀ ਕਿਉਂਕਿ ਉਹ ਅਕਸਰ ਸ਼ੁਰੂਆਤੀ ਜਨਮ ਰਜਿਸਟਰੇਸ਼ਨ ਕਾਗਜ਼ੀ ਕਾਰਵਾਈ ਵਿੱਚ ਸਹਾਇਤਾ ਕਰਦੇ ਹਨ ਅਤੇ ਪੁਸ਼ਟੀ ਕਰ ਸਕਦੇ ਹਨ ਕਿ ਜਨਮ ਦੀ ਸੂਚਨਾ ਉਸ ਸਥਾਨਕ ਅਧਿਕਾਰੀਆਂ ਨੂੰ ਦਿੱਤੀ ਗਈ ਹੈ ਜਾਂ ਨਹੀਂ ਜੇਕਰ ਹਸਪਤਾਲ ਨੇ ਪਹਿਲਾਂ ਹੀ ਜਨਮ ਵਿੱਚ ਨਾਮ ਦਰਜ ਨਹੀਂ ਕਰਵਾਇਆ ਤਾਂ ਤੁਹਾਨੂੰ ਪ੍ਰਕਿਰਿਆ ਸ਼ੁਰੂ ਕਰਨ ਲਈ ਆਪਣੇ ਸਥਾਨਕ ਸਿਵਲ ਰਜਿਸਟਰੇਸ਼ਨ ਦਫ਼ਤਰ ਵਿਚ ਰਿਕਾਰਡ ਵਿਭਾਗ ਸੰਪਰਕ ਕਰਨ ਦੀ ਜ਼ਰੂਰਤ ਹੋਵੇਗੀ ਆਮ ਤੌਰ 'ਤੇ ਰਜਿਸਟਰੇਸ਼ਨ ਜਨਮ ਤੋਂ ਬਾਅਦ ਇੱਕ ਨਿਸ਼ਚਿਤ ਸਮਾਂ ਸੀਮਾ ਦੇ ਅੰਦਰ ਅੰਦਰ ਹੋਣੀ ਚਾਹੀਦੀ ਹੈ ਜੋ ਅਧਿਕਾਰ ਖੇਤਰ ਦੁਆਰਾ ਵੱਖ ਵੱਖ ਹੁੰਦੀ ਹੈ ਸਾਰੇ ਲੋੜੀਂਦੇ ਦਸਤਾਵੇਜ਼ ਇਕੱਠੇ ਕਰੋ ਜਿਵੇਂ ਕਿ ਬੱਚੇ ਦਾ ਜਨਮ ਸਰਟੀਫਿਕੇਟ ਜੇਕਰ ਉਹ ਜਾਰੀ ਕੀਤਾ ਗਿਆ ਹੋਵੇ ਮਾਤਾ ਪਿਤਾ ਦੋਵਾਂ ਲਈ ਪਹਿਛਾਣ ਪੱਤਰ ਅਤੇ ਹਸਪਤਾਲ ਦੁਆਰਾ ਪ੍ਰਦਾਨ ਕੀਤੇ ਗਏ ਕੋਈ ਵੀ ਫਾਰਮ ਜਾਂ ਜਨਮ ਦਾ ਸਬੂਤ ਜਿਸ ਵਿੱਚ ਬੱਚੇ ਦੇ ਜਨਮ ਸੰਬੰਧੀ ਰਿਕਾਰਡ ਹੋਵੇ ਰਜਿਸਟ੍ਰੇਸ਼ਨ ਦਫ਼ਤਰ ਨੂੰ ਤੁਸੀਂ ਸਿੱਧੇ ਜਾ ਕੇ ਉਹਨਾਂ ਨੂੰ ਮਿਲੋ ਤਾਂ ਰਜਿਸਟਰਸ ਦੀ ਪ੍ਰਕਿਰਿਆ ਨੂੰ ਆਨਲਾਈਨ ਜਾਂ ਡਾਕ ਰਾਹੀਂ ਪੂਰਾ ਕਰੋ ਇਹ ਯਕੀਨੀ ਬਣਾਓ ਕਿ ਬੱਚੇ ਦੀ ਕਾਨੂੰਨੀ ਸਥਿਤੀ ਸਿਹਤ ਦੇਖਭਾਲ ਤੱਕ ਪਹੁੰਚ ਅਤੇ ਹੋਰ ਜ਼ਰੂਰੀ ਸੇਵਾਵਾਂ ਨੂੰ ਸੁਰੱਖਿਅਤ ਕਰਨ ਲਈ ਜਨਮ ਅਧਿਕਾਰਿਤ ਤੌਰ 'ਤੇ ਦਰਜ ਕੀਤਾ ਗਿਆ ਹੈ ਜੇਕਰ ਕੋਈ ਪ੍ਰੋਬਲਮ ਆਉਂਦੀ ਹੈ ਤੁਹਾਨੂੰ ਪ੍ਰਕਿਰਿਆ ਬਾਰੇ ਯਕੀਨ ਨਹੀਂ ਹੈ ਤਾਂ ਇਹ ਯਕੀਨ ਬਣਾਉਣ ਲਈ ਕਿ ਸਾਰੇ ਕ ਤੁਹਾਡੇ ਦੁਆਰਾ ਕੀਤੇ ਗਏ ਕੰਮ ਸਹੀ ਢੰਗ ਨਾਲ ਹੋਏ ਹਨ ਤਾਂ ਤੁਸੀਂ ਕਿਸੇ ਵੀ ਕਾਨੂੰਨੀ ਸਲਾਹਕਾਰ ਜਾਂ ਰਜਿਸਟਰੇਸ਼ਨ ਦਫ਼ਤਰ ਤੋਂ ਸਲਾਹ ਲੈ ਸਕਦੇ ਹੋ